ਕੁਛ ਦਿਨ ਪਹਿਲਾਂ ਹੀ ਮੈਂ ਇੱਕ ਵੈਨ ਲਈ ਸੀ ਜਿਸ ਦਾ ਰਜਿਸਟਰੇਸ਼ਨ ਮੈਨੂੰ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਕਰਵਾਇਆ ਜਾਂਦਾ ਹੈ ਫਿਰ ਮੈਂ ਆਪਣੇ ਇੱਕ ਮਿੱਤਰ ਨੂੰ ਫੋਨ ਕਰਕੇ ਪੁੱਛਿਆ ਕਿ ਇਸਦਾ ਰਜਿਸਟਰੇਸ਼ਨ ਕਿਵੇਂ ਕਰਵਾਇਆ ਜਾਂਦਾ ਹੈ ਉਸ ਨੇ ਪਿਛਲੇ ਦਿਨ ਹੀ ਇੱਕ ਵੈਨ ਲਈ ਸੀ